ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਯੋਗ ਦਾ ਅਭਿਆਸ ਕਰਨ ਤੋਂ ਬਾਅਦ ਬਹੁਤ ਮਾਨਸਿਕ ਅਤੇ ਸਰੀਰਕ ਸਿਹਤ ਅਨੁਭਵ ਚੀਜ਼ਾਂ ਦਾ ਅਨੁਭਵ ਕੀਤਾ ਹੈ ਸਭ ਤੋਂ ਪਹਿਲਾਂ ਮੇਰਾ ਮਨ ਕਾਫੀ ਜ਼ਿਆਦਾ ਸਾਫ ਅਤੇ ਕਲੀਅਰ ਹੋ ਚੁੱਕਿਆ ਹੈ ਇ ਜਿਸ ਇਹਦਾ ਮਤਲਬ ਇਹ ਹੈ ਕਿ ਮੈਂ ਆਪਣਾ ਮਨ ਇੱਕ ਪਾਸੇ ਕੇਂਦਰਿਤ ਬਹੁਤ ਸਹੀ ਤਰੀਕੇ ਨਾਲ ਕਰ ਪਾਉਂਦਾ ਹਾਂ ਦੂਜੇ ਮੈਨੂੰ ਫਾਇਦਾ ਇਹ ਹੋਇਆ ਹੈ ਕਿ ਮੇਰਾ ਡਿਸਟਰੈਕਸ਼ਨ ਨਹੀਂ ਹੁੰਦੀ ਜਾਂ ਮੈਂ ਇਹ ਕਹਿ ਸਕਦਾ ਕਿ ਜਿੱਦਾਂ ਦਾ ਕੋਈ ਕੰਮ ਕਰ ਰਿਹਾ ਅਤੇ ਮੇਰੇ ਲਾਗੇ ਫੋਨ ਪਿਆ ਆ ਕੋਈ ਇਹੋ ਜਿਹੀ ਚੀਜ਼ ਪਈ ਹੈ ਜਿਹਨੂੰ ਫੜ ਕੇ ਮੈਂ ਚਲਾਉਣ ਲੱਗ ਪਵਾਂ ਤਾਂ ਮੇਰਾ ਉਹਦੇ ਵੱਲ ਧਿਆਨ ਨਹੀਂ ਜਾਂਦਾ ਇਹ ਤਾਂ ਹੋ ਗਏ ਮਾਨਸਿਕ ਵਿਕਾਸ ਜਾਂ ਮਾਨਸਿਕ ਫਾਇਦੇ ਅਤੇ ਸਰੀਰਿਕ ਫਾਇਦੇ ਮੈਨੂੰ ਇਹ ਹੋਏ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਮੇਰੀ ਫਲੈਕਸੀਬਿਲਿਟੀ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਇਹਦਾ ਮਤਲਬ ਹੈ ਕਿ ਜਿੱਦਾਂ ਮੇਰਾ ਹੱਥ ਪਹਿਲਾਂ ਪਿੱਠ 'ਤੇ ਨਹੀਂ ਜਾਂਦਾ ਸੀ ਹੁਣ ਪੂਰਾ ਪਿੱਠ 'ਤੇ ਜਾਂਦਾ ਹੈ ਅਤੇ ਬਹੁਤ ਸੌਖਾ ਰਹਿੰਦਾ ਹੈ ਇਹਦੇ ਨਾਲ ਫਲੈਕਸੀਬਿਲਟੀ ਵਧਣ ਨਾਲ ਤੁਹਾਡਾ ਸਰੀਰ ਕਾਫੀ ਜ਼ਿਆਦਾ ਤੇਜ਼ ਅਤੇ ਚੁਸਤ ਹੋ ਜਾਂਦਾ ਹੈ ਅਤੇ ਤੀਜਾ ਮੈਂ ਕਹਾਂਗਾ ਕਿ ਇਮੋਸ਼ਨਸ ਬੈਟਰ ਹੋਏ ਆ ਅਤੇ ਸਟੈਮੀਨਾ ਵਧਿਆ ਹੈ ਸਟੈਮਿਨਾ ਵਧਣ ਦਾ ਮਤਲਬ ਇਹ ਹੀ ਹੈ ਕਿ ਪਹਿਲਾਂ ਜੇ ਮੈਂ ਦੌੜ ਲਾਉਂਦਾ ਵੀ ਦਸਾਂ ਮਿੰਟਾਂ 'ਚ ਥੱਕ ਜਾਂਦਾ ਸੀ ਹੁਣ ਮੈਂ ਵੀਹ ਤੋਂ ਪੱਚੀ ਮਿੰਟ ਮੇਰੇ ਨਾਲ ਦੌੜਨਾ ਲਾ ਪਾਉਂਦਾ ਅਤੇ ਬੜੇ ਅਸਾਨੀ ਨਾਲ ਨਹੀਂ ਥੱਕਦਾ ਅਤੇ ਇਮੋਸ਼ਨ ਬੈਟਰ ਹੋਣ ਦਾ ਮਤਲਬ ਇਹ ਹੈ ਕਿ ਪਹਿਲਾਂ ਮੈਂ ਕਿਤੇ ਵੀ ਕੁਛ ਵੀ ਸ਼ੋਅ ਕਰ ਲੈਂਦਾ ਸੀ ਅਤੇ ਹੁਣ ਮੈਂ ਕਾਫੀ ਜ਼ਿਆਦਾ ਕਾਮ ਯਾਨੀ ਕਿ ਸਥਿਰ ਰਹਿ ਪਾਉਂਦਾ ਅਤੇ ਆਪਣੇ ਆਪ ਨੂੰ ਸਹੀ ਮਹਿਸੂਸ ਕਰ ਪਾਉਂਦਾ ਆਪਣੇ ਆਪ ਨੂੰ ਮੈਂ ਬਿਹਤਰ ਅਤੇ ਚੰਗਾ ਮਹਿਸੂਸ ਕਰਦਾ ਹਾਂ ਜਦੋਂ ਮੈਂ ਯੋਗਾ ਦਾ ਅਭਿਆਸ ਕਰਦਾ ਹਾਂ